ਲਗਭਗ ਰੂਪਨਗਰ ਜ਼ਿਲ੍ਹੇ ਵਿੱਚ ਜ਼ਿਆਦਾਤਰ ਲੋਕ ਰਾਜ ਮਿਸਤਰੀ ਅਤੇ ਤਰਖਾਣ ਦਾ ਕੰਮ ਕਰਦੇ ਹਨ ਅਤੇ ਕੁਝ ਲੋਕ ਕਿਸਾਨ ਕੁਝ ਲੋਕ ਕਿਸਾਨੀ ਦਾ ਕੰਮ ਵੀ ਕਰਦੇ ਹਨ ਆਪਣੇ ਖੇਤਾਂ ਵਿੱਚ ਕੰਮ ਕਰਦੇ ਹਨ ਸਾਰਾ ਦਿਨ ਜਿਸ ਰਾਹੀਂ ਜ਼ਿਲ੍ਹੇ ਦੇ ਵਿੱਚ ਆਰਥਿਕ ਸਮੱਸਿਆਵਾਂ ਕਾਫੀ ਘੱਟ ਰਹੀਆਂ ਹਨ ਕਿਸਾਨ ਕਿਸਾਨ ਕਾਫੀ ਮਾਤਰਾ ਵਿੱਚ ਅਨਾਜ ਪੈਦਾ ਕਰਕੇ ਦੇਸ਼ ਨੂੰ ਦੇ ਰਹੇ ਹਨ ਪੰਜਾਬ ਵਿੱਚ ਜਿਵੇਂ ਰੂਪਨਗਰ ਪੰਜਾਬ ਦਾ ਹੀ ਜ਼ਿਲ੍ਹਾ ਹੈ ਪੰਜਾਬ ਦੇਸ਼ ਵਿੱਚ ਸਭ ਤੋਂ ਵੱਧ ਅਨਾਜ ਪੈਦਾ ਕਰਨ ਵਾਲਾ ਰਾਜ ਮੰਨਿਆ ਜਾਂਦਾ ਹੈ